ਹੈਲੋ ਹਾਂਜੀ ਡਾਕਟਰ ਅਮਨ ਬੋਲ ਰਹੇ ਹੋ ਤੁਸੀਂ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂ ਹਾਂਜੀ ਆਪਾਂ ਨੂੰ ਨਾ ਤੁਹਾਡੇ ਕੋਲੋਂ ਸਲਾਹ ਚਾਹੀਦੀ ਸੀ ਕਿ ਵੀ ਮੈਨੂੰ ਪੇਟ ਦੀ ਬਹੁਤ ਪ੍ਰੋਬਲਮ ਰਹਿੰਦੀ ਹੈਗੀ ਹੈ ਅਤੇ ਉਹਦੇ ਵਾਸਤੇ ਤੁਸੀਂ ਮੈਨੂੰ ਕੋਈ ਰਾਇ ਦਿਓ ਅਤੇ ਕੋਈ ਚੰਗੀ ਦਵਾਈ ਹੋਵੇ ਉਹ ਦੇ ਦਿਓ ਅਤੇ ਡਾਈਟ ਚਾਟ ਡਾਈਟ ਦਾ ਵੀ ਤੁਸੀਂ ਮੈਨੂੰ ਚਾਟ ਬਣਾ ਕੇ ਉਹ ਦੱਸਿਓ ਦੱਸੋ ਨਾਲੇ ਠੀਕ ਠੀਕ ਹਾਂਜੀ ਹਾਂਜੀ ਹਾਂਜੀ ਠੀਕ ਹੈ ਓਕੇ ਚਾਹ ਨਹੀਂ ਮੈਂ ਪੀ ਸਕਦੀ ਸਵੇਰੇ ਖਾਲੀ ਪੇਟ ਠੀਕ ਹੈ ਹੂੰ

ਹੂੰ ਹੂੰ ਠੀਕ ਹੈ ਹਾਂਜੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹੋਰ ਹਾਂਜੀ ਠੀਕ ਹੈ ਜੀ ਬਹੁਤ ਵਧੀਆ

ਠੀਕ ਹੈ

ਅਤੇ ਚਲੋ ਕਿੰਨੇ ਆਪਣੀ ਫੀਸ ਹੋਈ ਫੇਰ ਦੱਸ ਦਿਓ ਹੈ ਨਾ ਅਤੇ ਮੈਂ ਤੁਹਾਨੂੰ ਗੂਗਲ ਪੇ ਕਰ ਦਊਂਗੀ ਹਾਂਜੀ ਠੀਕ ਹੈ ਜੀ ਓਕੇ ਜੀ ਸ਼ੁਕਰੀਆ ਜੀ ਧੰਨਵਾਦ